ਜੇਕਰ ਕੋਈ ਵਿਅਕਤੀ ਚਿੱਤਰਕਾਰੀ ਨਾਲ ਸ਼ੁਰੂਆਤ ਕਰ ਰਿਹਾ ਹੈ ਤਾਂ ਉਸ ਨੂੰ ਸਭ ਤੋਂ ਪਹਿਲੀ ਸਲਾਹ ਤਾਂ ਮੈਂ ਇਹ ਦੇਣਾ ਚਾਹਾਂਗਾ ਕਿ ਉਹ ਪਹਿਲਾਂ ਚਿੱਤਰਕਾਰੀ ਦੇ ਬੇਸਿਕ ਪ੍ਰਿੰਸੀਪਲ ਸਿੱਖੇ ਕਿਉਂਕਿ ਉਹ ਚਿੱਤਰਕਾਰੀ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੁੰਦੇ ਹਨ ਅੱਜ ਕੱਲ੍ਹ ਤਾਂ ਇਹ ਚੀਜ਼ਾਂ ਇੰਟਰਨੈਟ 'ਤੇ ਯੂਟਿਊਬ 'ਤੇ ਬਹੁਤ ਈਜ਼ੀਲੀ ਅਵੇਲੇਬਲ ਹਨ ਕੋਈ ਵੀ ਇਨਸਾਨ ਯੂਟਿਊਬ ਉੱਤੇ ਜਾ ਕੇ ਚਿੱਤਰਕਾਰੀ ਸਿੱਖ ਸਕਦਾ ਹੈ ਇਸ ਕਰਕੇ ਮੇਰੀ ਆਹ ਹੀ ਸਲਾਹ ਹੋਏਗੀ ਕਿ ਸਭ ਤੋਂ ਪਹਿਲਾਂ ਇੰਟਰਨੈਟ 'ਤੇ ਵਿਅਕਤੀ ਜਾਵੇ ਅਤੇ ਚਿੱਤਰਕਾਰੀ ਦੇ ਬੇਸਿਕਸ ਸਿੱਖੇ ਤਾਂ ਜੋ ਉਹ ਉਸ ਤੋਂ ਅੱਗੇ ਦੀਆਂ ਵੀ ਚੀਜ਼ਾਂ ਬਣਾ ਸਕੇ ਚਿੱਤਰਕਾਰੀ ਦੇ ਲਈ ਜੋ ਵੀ ਸਮਾਨ ਚਾਹੀਦਾ ਹੁੰਦਾ ਹੈ ਉਹ ਵੀ ਬਹੁਤ ਆਸਾਨੀ ਨਾਲ ਆਪਣੀ ਨਾਲ ਦੀਆਂ ਹੀ ਦੁਕਾਨਾਂ ਤੋਂ ਮਿਲ ਜਾਂਦਾ ਹੈ ਕੋਈ ਵੀ ਇਨਸਾਨ ਸਿਰਫ ਇੱਕ ਪੈਨਸਿਲ ਅਤੇ ਇੱਕ ਕਾਗਜ਼ ਨਾਲ ਚਿੱਤਰਕਾਰੀ ਸ਼ੁਰੂ ਕਰ ਸਕਦਾ ਹੈ ਬਾਕੀ ਅਗਰ ਕਿਸੇ ਇਨਸਾ ਵਿਅਕਤੀ ਨੇ ਚਿੱਤਰਕਾਰੀ ਵਿੱਚ ਅੱਗੇ ਦਾ ਵੀ ਕੁਛ ਕਰਨਾ ਹੈ ਤਾਂ ਉਹ ਕਿਸੇ ਕੋਲਜ ਵਗੈਰਾ ਨੂੰ ਵੀ ਜੁਇਨ ਕਰ ਸਕਦਾ ਹੈ ਅੱਜ ਕੱਲ੍ਹ ਤਾਂ ਕੋਲਜ ਅਤੇ ਯੂਨੀਵਰਸਿਟੀਆਂ ਵਿੱਚ ਵੀ ਚਿੱਤਰਕਾਰੀ ਦੇ ਕੋਰਸ ਹੋਣ ਲੱਗ ਗਏ ਹਨ ਇਸ ਤਰ੍ਹਾਂ ਇਨਸਾਨ ਆਪਣੀ ਚਿੱਤਰਕਾਰੀ ਦਾ ਪ੍ਰੋਫੈਸ਼ਨ ਸ਼ੁਰੂ ਕਰ ਸਕਦਾ ਹੈ ਅਤੇ ਅੱਗੇ ਵਧਾ ਸਕਦਾ ਹੈ